ਹਾਂ ਮੈਂ ਸ਼ੂਟਿੰਗ ਸਟਾਰ ਦੇਖਿਆ ਵਾ ਜਦੋਂ ਆਪਾਂ ਛੋਟੇ ਹੁੰਦੇ ਹਾਂ ਅਤੇ ਆਪਾਂ ਆਸਮਾਨ ਵੱਲ ਦੇਖਦੇ ਹਾਂ ਅਤੇ ਬਾਕੀ ਜਿਹੜੇ ਤਾਰੇ ਆ ਉਹ ਸਾਨੂੰ ਬੜੇ ਛੋਟੇ ਛੋਟੇ ਦਿਖਾਈ ਦਿੰਦੇ ਆ ਪਰ ਜਦੋਂ ਇਹ ਤਾਰਾ ਮਤਲਬ ਕਿ ਟੁੱਟਦਾ ਵਾ ਅਤੇ ਇਹ ਇਹ ਜਦੋਂ ਮਤਲਬ ਕਿ ਬਾਕੀ ਤਾਰਿਆਂ ਦੇ ਵਿੱਚੋਂ ਦੀ ਲੰਘਦਾ ਵਾ ਅਤੇ ਸਾਨੂੰ ਬੜਾ ਵੱਡਾ ਦਿਖਾਈ ਦਿੰਦਾ ਵਾ ਅਤੇ ਜਦੋਂ ਇਹ ਕਿਸੇ ਚਟਾਨ ਦੇ ਨਾਲ ਟਕਰਾ ਕੇ ਟੁੱਟਦਾ ਵਾ ਤਾਂ ਬੜੀ ਰੌਸ਼ਨੀ ਜੀ ਮਤਲਬ ਕਿ ਪੈਦਾ ਹੁੰਦੀ ਆ ਅਤੇ ਵੇਖਣ 'ਚ ਵੀ ਸਾਨੂੰ ਬੜੀ ਵਧੀਆ ਲੱਗਦੀ ਆ ਅਤੇ ਮੈਂ ਤਾਂ ਬਚਪਨ ਤੋਂ ਹੀ ਇਸ ਚੀਜ਼ ਵਿੱਚ ਬੜਾ ਦਿਲਚਸ ਦਿਲਚਸਪੀ ਲੈਂਦੀ ਆਈ ਹਾਂ ਅਤੇ ਏਨ ਇਹ ਜਿਹੜਾ ਵਾ ਆਪਾਂ ਮਤਲਬ ਕਿ ਜਦੋਂ ਛੋਟੀ ਹੁੰਦੇ ਹਾਂ ਤਾਂ ਇਹ ਵੀ ਜ਼ਿਆਦਾ ਮੰਨਿਆ ਜਾਂਦਾ ਅਤੇ ਕਿ ਘਰ ਘਰ ਵਿੱਚ ਹੀ ਇਹੋ ਗੱਲ ਚਲਦੀ ਹੁੰਦੀ ਕਿ ਜਦੋਂ ਵੀ ਕੋਈ ਟੁੱਟਦਾ ਤਾਰਾ ਵੇਖਦਾ ਵਾ ਅਤੇ ਉਹਦੇ ਕੋਲੋਂ ਜੋ ਵੀ ਆਪਣੀ ਇੱਛਾ ਮੰਗਦਾ ਵਾ ਉਹ ਪੂਰੀ ਹੁੰਦੀ ਆ ਤਾਂ ਮੈਂ ਵੀ ਜਦੋਂ ਛੋਟੀ ਹੁੰਦੀ ਹੁੰਦੀ ਹਾਂ ਮੈਨ ਮੇਰਾ ਵੀ ਸੁਪਨਾ ਹੁੰਦਾ ਸੀ ਕਿ ਮੈਂ ਮੇਰੀ ਆਹ ਇੱਛਾ ਪੂਰੀ ਹੋਵੇ ਜਾਂ ਮੈਂ ਵੱਡੀ ਹੋ ਕੇ ਆਹ ਬਣਾ ਤਾਂ ਮੈਂ ਜਦੋਂ ਵੀ ਆਸਮਾਨ ਵਿੱਚ ਸ਼ੂਟਿੰਗ ਸਟਾਰ ਨੂੰ ਦੇਖਣਾ ਤਾਂ ਮੈਂ ਉਹਨੂੰ ਵੇਖ ਕੇ ਅੱਖਾਂ ਬੰਦ ਕਰਕੇ ਆਪਣੀ ਇੱਛਾ ਮੰਗਣੀ ਹਾਂ ਏ ਇਹ ਵੀ ਗੱਲ ਸੱਚ ਆ ਜੋ ਇੱਛਾ ਮੰਗੀਦੀ ਚਲੋ ਉਹ ਪੂਰੀ ਵੀ ਹੁੰਦੀ ਹੈ